ਮੇਰਾ ਨਾਮ ਅਰਾਧਨਾ ਹੈ ਮੈਂ ਪਠਾਨਕੋਟ ਜ਼ਿਲ੍ਹੇ ਦੀ ਰਹਿਣ ਵਾਲੀ ਹਾਂ ਅਸੀਂ ਵਿਸਾਖੀ ਦੇ ਬਾਰੇ ਕੁਝ ਗੱਲ ਕਰਦੇ ਹਾਂ ਅਸੀਂ ਵਿਸਾਖੀ ਦੀ ਇਹ ਗੱਲ ਕਰਦੇ ਹਾਂ ਕਿ ਵਿਸਾਖੀ ਜਿਹੜੀ ਹੈ ਉਹਦਾ ਵਿਕਾਸ ਕਿਵੇਂ ਹੋਇਆ ਜਦੋਂ ਪਹਿਲੇ ਲੋਕ ਵਿਸਾਖੀ ਮਨਾਉਂਦੇ ਸਨ ਤਾਂ ਉਹ ਜਿਹੜੇ ਭਾਈ ਸਰਦਾਰ ਭਾਈਚਾਰੇ ਦੇ ਲੋਕ ਕਿਸਾਨ ਹੁੰਦੇ ਸੀ ਉਹ ਆਪਣੇ ਖੇਤਾਂ ਵਿੱਚ ਵਿਸਾਖੀ ਦਾ ਤਿਉਹਾਰ ਬੜੀ ਹੀ ਧੂਮਧਾਮ ਨਾਲ ਮਨਾਉਂਦੇ ਹੀ ਜਦੋਂ ਵਿਸਾਖੀ ਆਉਂਦੀ ਸੀ ਤਾਂ ਉਹ ਕਹਿੰਦੇ ਸਨ ਕਿ ਸਾਡਾ ਜਿਹੜਾ ਇਹ ਪੂਰਾ ਵਿਸਾਖ ਦਾ ਮਹੀਨਾ ਆਇਆ ਹੈ ਇਹ ਸਾਰਾ ਖੁਸ਼ੀਆਂ ਭਰਿਆ ਹੈ ਕਿਉਂਕਿ ਉਹਨਾਂ ਦੀ ਅੱਛੀ ਫਸਲ ਹੋਣ ਕਾਰਨ ਉਹ ਆਪਣੀ ਫਸਲ ਦੀ ਕਟਾਈ ਕਰਦੇ ਸਨ ਜਿਸ ਜਿਸ ਦਿਨ ਵਿਸਾਖੀ ਹੁੰਦੀ ਸੀ ਉਹ ਉਸ ਦਿਨ ਸ਼ੁਭ ਮਹੂਰਤ ਦੇ ਵਿਸਾਖੀ ਦੀ ਕਟਾਈ ਕਰਦੇ ਸਨ ਅਤੇ ਉਹ ਆਪਣੇ ਘਰ ਦੇ ਅੱਛੇ ਅੱਛੇ ਪਕਵਾਨ ਬਣਾ ਕੇ ਲੈ ਜਾਂਦੇ ਸੀ ਅਤੇ ਉਹ ਆਪਣੇ ਖੇਤਾਂ ਵਿੱਚ ਬਹਿ ਕੇ ਸਾਰੇ ਆਪਸ 'ਚ ਮਿਲ ਕੇ ਉਹ ਨਾਲ ਉਹਨੂੰ ਖਾਂਦੇ ਸੀ ਅਤੇ ਨਾਲੇ ਪ੍ਰਸ਼ਾਦ ਦੇ ਰੂਪ ਵਿੱਚ ਵੰਡਦੇ ਸੀ ਜਦੋਂ ਉਹ ਵਿਸਾਖੀ ਦਾ ਤਿਉਹਾਰ ਮਨਾਉਂਦੇ ਸੀ ਅਤੇ ਜਿਹੜੇ ਸਰਦਾਰ ਭਾਈਚਾਰੇ ਦੇ ਲੋਕ ਹੁੰਦੇ ਸੀ ਜਿਹੜੇ ਉਹਨਾਂ ਵਿੱਚ ਮਰਦ ਹੁੰਦੇ ਸੀ ਉਹ ਭੰਗੜਾ ਪਾਉਂਦੇ ਸੀ ਅਤੇ ਜਿਹੜੀਆਂ ਉਹਨਾਂ ਵਿੱਚ ਜਨਾਨੀਆਂ ਕੁਝ ਔਰਤਾਂ ਹੁੰਦੀਆਂ ਸਨ ਕੁੜੀਆਂ ਹੁੰਦੀਆਂ ਸਨ ਉਹ ਗਿੱਧਾ ਪਾਉਂਦੀਆਂ ਸਨ ਅਤੇ ਉਹ ਥੋੜ੍ਹਾ ਲੋਕ ਨਾਚ ਕਰਕੇ ਆਪਣਾ ਵਿਸਾਖੀ ਦਾ ਤਿਉਹਾਰ ਬੜੀ ਹੀ ਧੂਮਧਾਮ ਨਾਲ ਮਨਾਉਂਦੇ ਸੀ ਅਤੇ ਜੇ ਅਸੀਂ ਗੱਲ ਕਰਦੇ ਹਾਂ ਆਧੁਨਿਕ ਸਮੇਂ ਵਿੱਚ ਵਿਸਾਖੀ ਕਿਸ ਤਰ੍ਹਾਂ ਮਨਾਈ ਜਾਂਦੀ ਹੈ ਆਧੁਨਿਕ ਨ ਸਮੇਂ ਵਿੱਚ ਵਿਸਾਖੀ ਮਨਾਉਣ ਦਾ ਕਿਤੇ ਰਿਹਾ ਵਿਸਾਖੀ ਜਗ੍ਹਾ ਹੀ ਨਹੀਂ ਰਹੀ ਵਿਸਾਖੀ ਮਨਾਉਣ ਵਾਸਤੇ ਕਿ ਅਸੀਂ ਮੇਲਾ ਕਿੱਥੇ ਲਗਾਈਏ ਜੇਕਰ ਅਸੀਂ ਸ਼ਹਿਰਾਂ ਦੀ ਗੱਲ ਕਰਦੇ ਹਾਂ ਤਾਂ ਅੱਜ ਕੱਲ੍ਹ ਦੇ ਬੱਚਿਆਂ ਨੂੰ ਤਾਂ ਵਿਸਾਖੀ ਦੇ ਬਾਰੇ ਕੁਝ ਇੰਨੀ ਜਾਣਕਾਰੀ ਵੀ ਨਹੀਂ ਹੈ ਸਮਾਂ ਇੰਨਾਂ ਕੁ ਡਿਜਟਲ ਹੋ ਗਿਆ ਹੈ ਕਿ ਬੱਚਿਆ ਨੂੰ ਵਿਸਾਖੀ ਦੇ ਬਾਰੇ ਕੁਛ ਵੀ ਨਹੀਂ ਪਤਾ ਵਿਸਾਖੀ ਦਾ ਤਿਉਹਾਰ ਕਿਵੇਂ ਮਨਾਇਆ ਜਾਂਦਾ ਹੈ ਬੱਚੇ ਆਪਣੇ ਮਾਤਾ ਪਿਤਾ ਨੂੰ ਪੁੱਛਦੇ ਹਨ ਕਿ ਇਹ ਵਿਸਾਖੀ ਹੁੰਦੀ ਕੀ ਹੈ ਤਾਂ ਮਾਤਾ ਪਿਤਾ ਉਹਨਾਂ ਨੂੰ ਦੱਸਦੇ ਹਨ ਕਿ ਜਦੋਂ ਪਹਿਲੇ ਵਿਸਾਖੀ ਮਨਾਉਂਦੇ ਸੀ ਤਾਂ ਕਿਸਾਨਾਂ ਦੀ ਫਸਲ ਦੀ ਕਟਾਈ ਹੁੰਦੀ ਸੀ ਅਤੇ ਕਿਸਾਨ ਆਪਣਾ ਇਹ ਵਿਸਾਖੀ ਦਾ ਤਿਉਹਾਰ ਜਿਹੜਾ ਆ ਉਹ ਮਨਾਉਂਦੇ ਸੀ ਉਹਨਾਂ ਦੀ ਫਸਲਾਂ ਉਹਨਾਂ ਦੇ ਘਰ ਆਉਂਦੀ ਸੀ ਅਤੇ ਉਹ ਉਸੇ ਫਸਲ ਨੂੰ ਵੇਚ ਕੇ ਪੈਸੇ ਵੱਟ ਕੇ ਆਪਣੇ ਲਾਲਨ ਪਾਲਣ ਦਾ ਗੁਜ਼ਾਰਾ ਕਰਦੇ ਸੀ ਆਪਣੇ ਪਰ ਬੱਚਿਆਂ ਦੀ ਪਰਵਰਿਸ਼ ਕਰਦੇ ਸੀ ਅਤੇ ਹੁਣ ਇਹ ਬੱਚਾ ਆਉਣ ਵਾਲੀ ਜਿਹੜੀ ਸਮਾਂ ਆ ਇਸ ਸਮੇਂ ਵਿੱਚ ਵਿਸਾਖੀ ਮਨਾਉਣਾ ਤਾਂ ਕਿਤੇ ਰਿਹਾ ਵਿਸਾਖੀ ਦਾ ਤਿਉਹਾਰ ਵੀ ਬੱਚਿਆਂ ਨੂੰ ਕੁਛ ਨਹੀਂ ਪਤਾ ਚੱਲਦਾ ਅਤੇ ਵਿਸਾਖੀ ਮਨਾਉਣ ਲਈ ਅਸੀਂ ਇਹੋ ਕਹਿੰਦੇ ਹਾਂ ਕਿ ਵਿਸਾਖੀ ਦਾ ਤਿਉਹਾਰ ਜਿਹੜਾ ਹੈ ਇਹ ਮਨਾਉਣਾ ਚਾਹੀਦਾ ਹੈ ਵਿਸਾਖੀ ਇੱਕ ਬਹੁਤ ਹੀ ਵੱਡਾ ਤਿਉਹਾਰ ਹੈ ਸਾਨੂੰ ਆਪਣੇ ਬੱਚਿਆਂ ਨੂੰ ਦੱਸਣਾ ਚਾਹੀਦਾ ਹੈ ਕਿ ਵਿਸਾਖੀ ਜਿਹੜੀ ਇਹ ਸਾਨੂੰ ਭੋਜਨ ਵਗੈਰਾ ਸਭ ਕੁਝ ਦਿੰਦੀ ਹੈ